ਰੰਗੋਲੀ ਰੰਗੋਲੀ ਸਾਰੇ ਤਿਉਹਾਰਾਂ 'ਤੇ ਬਣਾਈ ਜਾਂਦੀ ਹੈ ਜਿਵੇਂ ਕਿ ਅਸੀਂ ਦਿਵਾਲੀ ਦੇ ਅਤੇ ਰੰਗੋਲੀ ਰੰਗੋਲੀ ਹੋਲੀ ਦੇ ਤਿਉਹਾਰ 'ਤੇ ਵੀ ਬਣਾਉਂਦੇ ਹਾਂ ਅਤੇ ਦਰਵਾਜੇ ਦੇ ਮਰੂ ਮੂਰੇ ਬਣਾ ਬਣਾਉਂਦੇ ਹਾਂ ਅਤੇ ਸੂਰਜ ਨੂੰ ਪਾਣੀ ਚੜਾਉਣਾ ਜ਼ਿਆਦਾਤਰ ਇਹ ਇਹ ਬ੍ਰਾਹਮਣ ਬ੍ਰਾਹਮਣ ਕਰਦੇ ਹਨ ਇਹ ਬ੍ਰਾਹਮਣ ਧਰਮ ਦੇ ਲੋਕ ਹਰਿਦੁਆਰ ਜਾ ਕੇ ਸੂਰਜ ਨੂੰ ਪਾਣੀ ਚੜ੍ਹਾਉਂਦੇ ਹਨ ਅਤੇ ਮੱਥੇ 'ਤੇ ਸੰਧੂਰ ਲਾਉਣਾ ਸਹ ਜ਼ਿਆਦਾਤਰ ਸੁਹਾਗਣਾ ਲਗਾਉਂਦੀਆਂ ਹਨ ਸੰਧੂਰ ਸੰਧੂਰ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਅਤੇ ਪੂਜਾ ਲਈ ਮੰਦਰ ਜਾਣਾ ਮੰਦਰ ਮੰਦਰ ਜਾ ਕੇ ਸ਼ਿਵ ਜੀ ਦੀ ਪੂਜਾ ਕਰਨੀ ਅਤੇ ਪੂਜਾ ਕਰਕੇ ਮੰਨਤ ਮੰਨਤ ਮੰਗਦੇ ਹਨ ਲੋਕ ਸ਼ਿਵ ਜੀ ਦੇ ਵਰਤ ਵੀ ਰੱਖਦੇ ਹਨ ਅਤੇ ਵਰਤ ਰੱਖਣ ਨਾਲ ਲੋਕ ਮੰਨਦੇ ਹਨ ਕਿ ਸ਼ ਜੋ ਸ਼ੁਭਕਾਮ ਹੈ ਆਪਣੀਆਂ ਮਨੋਕਾਮਨਾ ਨੇ ਉਹ ਪੂਰੀਆਂ ਹੁੰਦੀਆਂ ਹਨ ਅਤੇ ਦਰਗਾਹ 'ਤੇ ਜਾਣਾ ਮੁਸਲਿਮ ਧਰਮ ਦੇ ਲੋਕ ਦਰਗਾਹ 'ਤੇ ਜਾਂਦੇ ਹਨ ਮੂਸੇ ਅਤੇ ਮੁਸਲਿਮ ਲੋਕ ਰੋਜਾ ਵੀ ਰੱਖਦੇ ਹਨ ਵਰਤ ਵਰਤ ਹਿੰਦੂ ਲੋਕ ਲੋਕ ਰੱਖਦੇ ਹਨ ਕਰਵਾ ਚੌਥ ਦੇ ਵਰਤ ਸੁਹਾਗਣਾ ਰੱਖਦੀਆਂ ਹਨ ਇਹਨਾਂ ਤੋਂ ਇਲਾਵਾ ਸਾਡੇ ਸੱਭਿਆਚਾਰ ਵਿੱਚ ਬਹੁਤ ਹੀ ਰੀਤੀ ਰਿਵਾਜ਼ ਹਨ ਜਿਵੇਂ ਕਿ ਭਰਾ ਨੂੰ ਰੱਖੜੀ ਬੰਨਣਾ ਇੱਕ ਭੈਣ ਵੱਲੋਂ ਭਰਾ ਨੂੰ ਰੱਖੜੀ ਬੰਨੀ ਜਾਂਦੀ ਹੈ ਅਤੇ ਭਰਾ ਆ ਅਤੇ ਭਰਾ ਨੂੰ ਜੌਂ ਵੀ ਟੰਗੇ ਜਾਂਦੇ ਹਨ ਅਤੇ ਭਾਈ ਦੂਜ ਵੀ ਮਨਾਇਆ ਜਾਂਦਾ ਹੈ ਅਤੇ ਦਿਵਾਲੀ ਦਾ ਤਿਉਹਾਰ ਵੀ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ